ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਕਾਫੀ ਵਧੀਆ ਮਿਲ ਰਹੀਆਂ ਹਨ ਇੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਨਾਂ ਤਰ੍ਹਾਂ ਦੇ ਹਸਪਤਾਲ ਮੌਜੂਦ ਆ ਜਿੱਥੇ ਲੋਕ ਪਹੁੰਚ ਕੇ ਆਪਣੀਆਂ ਬਿਮਾਰੀਆਂ ਦਾ ਹੱਲ ਕਰਵਾਉਂਦੇ ਨੇ ਸਰਕਾਰੀ ਹਸਪਤਾਲਾਂ ਵਿੱਚ ਫਰੀ ਇਲਾਜ ਮਿਲ ਜਾਂਦਾ ਹੈ ਜੋ ਘੱਟ ਪੈਸਿਆਂ ਦੇ ਵਿੱਚ ਅਤੇ ਪ੍ਰਾਈਵੇਟ ਹਸਪਤਾਲ ਥੋੜ੍ਹੇ ਮਹਿੰਗੇ ਹੋਣ ਕਾਰਨ ਲੋਕਾਂ ਨੂੰ ਚੰਗੀਆਂ ਸੇਵਾਵਾਂ ਵੀ ਉਸ ਦੇ ਨਾਲ ਦਿੰਦੇ ਹਨ ਅਤੇ ਕੁਝ ਗਰੀਬ ਲੋਕ ਜੋ ਹੈ ਉਹ ਕੁਝ ਐੱਨ ਜੀ ਓ ਜੋ ਬਣੀਆਂ ਨੇ ਜੋ ਭਾਈਚਾਰਕ ਲੋੜਾਂ ਨੂੰ ਉਹਨਾਂ ਦੀਆਂ ਨੂੰ ਪੂਰਾ ਕਰਦਿਆਂ ਉਹਨਾਂ ਦੀ ਹਰ ਤਰ੍ਹਾਂ ਦੇ ਸਹਾਇਤਾ ਕਰਦੀਆਂ ਨੇ ਅਤੇ ਡੋਕਟਰ ਸਾਹਿਬਾਨ ਕਾਫੀ ਖਿਆਲ ਰੱਖਦੇ ਨੇ ਇਸ ਤਰ੍ਹਾਂ ਅੰਮ੍ਰਿਤਸਰ ਸਿਹਤ ਸੇਵਾਵਾਂ ਪੱਖੋਂ ਨੰਬਰ ਵਨ 'ਤੇ ਗਿਣਿਆ ਜਾ ਸਕਦਾ ਹੈ ਇਸ ਦੇ ਵਿੱਚ ਐਂਬੂਲੈਂਸ ਸਰਵਿਸ ਮੈਡੀਕਲ ਕੋਲਜ ਹੈਲਥ ਵਾਸਤੇ ਸਬ ਸੈਂਟਰ ਅਤੇ ਕੌਂਸਲਿੰਗ ਅੱਛੇ ਤਰੀਕੇ ਨਾਲ ਕੀਤ ਹੋ ਰਹੀ ਹੈ ਆਵਾਜਾਈ ਦੇ ਸਾਧਨ ਠੀਕ ਠਾਕ ਹਨ ਜਿਸ ਦੇ ਨਾਲ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ